ਮੈਂ ਦਸ ਦਿਨ ਪਹਿਲਾਂ ਫਲਿੱਪਕਾਰਟ ਤੋਂ ਹੈੱਡਫ਼ੋਨ ਮੰਗਵਾਏ ਸੀਗੇ ਤਾਂ ਜਿਸ ਕਾਰਨ ਉਹ ਕੱਲ੍ਹ ਆ ਗਏ ਸੀਗੇ ਅਤੇ ਮੈਂ ਇਹਦੀ ਪੈਕਿੰਗ ਹੀ ਦੇਖ ਕੇ ਬਹੁਤ ਨਿਰਾਸ਼ ਹੋਇਆ ਕਿਉਂਕਿ ਇਹ ਪਹਿਲਾ ਹੀ ਬਹੁਤ ਖਰਾਬ ਸੀਗੇ ਅਤੇ ਜੀ ਜਦੋਂ ਮੈਂ ਇਹਨੂੰ ਆਪਣੀ ਹਿੰਮਤ ਕਰਕੇ ਇਹਨੂੰ ਖੋਲ੍ਹਿਆ ਤਾਂ ਫਿਰ ਮੈਂ ਖੋਲ੍ਹਦੇ ਸਾਰ ਹੀ ਦੇਖਿਆ ਅਤੇ ਇਹ ਮੈਨੂੰ ਦਿਖਣ 'ਚ ਹੀ ਖਰਾਬ ਲੱਗ ਰਹੇ ਸੀਗੇ ਅਤੇ ਫਿਰ ਮੈਂ ਇਹਨੂੰ ਜਦੋਂ ਕਨੈਕਟ ਕੀਤਾ ਆਪਣੇ ਬਲੂਥੂਥ ਨਾਲ ਉਸ ਟਾਈਮ ਕਨੈਕਟ ਹੋਇਆ ਨਹੀਂ ਫਿਰ ਮੈਂ ਥੋੜ੍ਹੀ ਦੇਰ ਬਾਅਦ ਇੱਕ ਵਾਰੀ ਹੋਰ ਫਿਰ ਕੀਤਾ ਫਿਰ ਜਦੋਂ ਹੋ ਗਿਆ ਅਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਕੰਨ 'ਚ ਲਗਾ ਕੇ ਆਵਾਜ਼ ਸੁਣੀ ਤਾ ਇਹਦੀ ਇੱਕ ਬਾਰ ਆਵਾਜ਼ ਬਹੁਤ ਬੇਕਾਰ ਸੀ ਜਿਸ ਕਾਰਨ ਮੇਰਾ ਕੰਨ ਵੀ ਦੁੱਖਣ ਲੱਗ ਗਏ ਅਤੇ ਇਹ ਮੈਨੂੰ ਫਲਿੱਪਕਾਰਟ 'ਤੇ ਸੱਤ ਹਜ਼ਾਰ ਦੇ ਮਿਲੇ ਅਤੇ ਉਸ ਤੋਂ ਬਾਅਦ ਜਦੋਂ ਇਹ ਮੈਨੂੰ ਪਤਾ ਲੱਗੇ ਕਿ ਇਹ ਖਰਾਬ ਆ ਅਤੇ ਫਿਰ ਮੈਂ ਵਾਪਸ ਰਿਪੇ ਰਿਪਲੇਸ ਕੀਤਾ ਤਾਂ ਫਿਰ ਮੈਨੂੰ ਤਾਂ ਲੱਗਦਾ ਨਹੀਂ ਸੀਗਾ ਕਿ ਇਹ ਰਿਪਲੇਸ ਹੋਉਂਗੇ ਅਤੇ ਜਿਸ ਕਾਰਨ ਮੈਨੂੰ ਮੇਰੇ ਘਰਦਿਆਂ ਨੇ ਬਹੁਤ ਬੋਲਿਆ ਅਤੇ ਮੇਰਾ ਇਹ ਇਸ ਵਾਰ ਦਾ ਐਕਸਪੀਰੀਅੰਸ ਬਹੁਤ ਖ਼ਰਾਬ ਰਿਹਾ